ਪੇਂਡੂ ਖੇਤਰਾਂ ਦੀ ਸੱਭਿਅਤਾ ਨੂੰ ਅ ਬਚਾਉਣ ਲਈ ਜਿਹੜੀਆਂ ਖੇਡਾਂ ਨੇ ਉਹ ਮਤਲਬ ਬਹੁਤ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਨੇ ਅਤੇ ਕਹਿ ਲਓ ਕਿ ਜਿਹੜੀਆਂ ਖੇਡਾਂ ਨੇ ਖਤਮ ਹੋ ਗਈਆਂ ਤਾਂ ਪੰਜਾਬ ਦਾ ਜਾਂ ਜਿਹੜਾ ਆਪਣਾ ਸੱਭਿਆਚਾਰ ਹੈ ਉਹ ਲਗਭਗ ਅੱਧ ਤੋਂ ਜ਼ਿਆਦਾ ਜਿਹੜਾ ਸੱਭਿਆਚਾਰ ਉਹ ਖਤਮ ਹੋਜੂਗਾ ਜਿਵੇਂ ਕਿ ਪੁਰਾਣੇ ਟਾਈਮ 'ਚ ਕੀ ਹੁੰਦਾ ਸੀਗਾ ਜਿਹੜੀਆਂ ਖੇਡਾਂ ਸੀਗੀਆਂ ਉਹ ਅਲੱਗ ਅਲੱਗ ਤਰ੍ਹਾਂ ਦੀਆਂ ਖੇਡਾਂ ਸੀਗੀਆਂ ਜਿਵੇਂ ਮਰਦਾਂ ਦੀਆਂ ਅਲੱਗ ਸੀਗੀਆਂ ਅਤੇ ਔਰਤਾਂ ਲਈ ਅਲੱਗ ਸੀਗੀਆਂ ਜਿਵੇਂ ਮਰ ਔਰਤਾਂ ਦੀਆਂ ਖੇਡਾਂ 'ਚ ਆ ਗਈਆਂ ਜਿਵੇਂ ਖੋ ਖੋ 'ਤੇ ਮਰਦਾਂ ਦੀਆਂ ਖੇਡਾਂ 'ਚ ਕਬੱਡੀ ਕੁਸ਼ਤੀ ਠੀਕ ਹੈ ਅਤੇ ਬਲਦਾਂ ਦੀਆਂ ਰੇਸਾਂ ਹਾਕੀ ਅਤੇ ਜਿਵੇਂ ਕੁਸ਼ਤੀ ਕਬੱਡੀ ਵਿੱਚ ਆਪਣਾ ਜਿਹੜੇ ਪੁਰਾਣੇ ਲੋਕ ਹੁੰਦੇ ਸੀਗੇ ਅਤੇ ਨੌਜਵਾਨ ਅਤੇ ਉਹ ਆਪਣਾ ਪੂਰਾ ਜਿਹੜਾ ਜ਼ੋਰ ਦਾ ਪ੍ਰਦਰਸ਼ਨ ਕਰਦੇ ਸੀਗੇ ਅਤੇ ਜਿਸ ਤੋਂ ਖੁਸ਼ ਹੋ ਕੇ ਪਿੰਡ ਦੇ ਲੋਕ ਉਹਨਾਂ ਦੀ ਪੂਰੀ ਪ੍ਰਸ਼ੰਸਾ ਕਰਦੇ ਸੀਗੇ ਅਤੇ ਜਿੰਨਾਂ ਵੀ ਆਪਣਾ ਬਣਦਾ ਉਹਨਾਂ ਨੂੰ ਧਨ ਦੀ ਜਿਹੜੀ ਹੈ ਉਹਨਾਂ ਨੂੰ ਇਨਾਮ ਦਿੱਤਾ ਜਾਂਦਾ ਸੀਗਾ ਅਤੇ ਇਹਦੇ ਨਾਲ ਨਾਲ ਜਿਵੇਂ ਆਪਣੀਆਂ ਖੇਡਾਂ ਨੇ ਇੱਕ ਬਹੁਤ ਹੀ ਵੱਡਾ ਰੋਲ ਪਲੇਅ ਕਰਦੀਆਂ ਨੇ